ਬਾਹਰੀ ਗਤੀਵਿਧੀਆਂ ਬਾਹਰੀ ਗਤੀਵਿਧੀਆਂ ਦਾ ਆਨੰਦ ਮੈਂ ਮਕਸਰ ਬਾਹਰੀ ਗਤੀਵਿਧੀਆਂ ਵਿੱਚੋਂ ਸਭ ਤੋਂ ਜ਼ਿਆਦਾ ਮੈਨੂੰ ਸਭ ਤੋਂ ਵਧੀਆ ਜੋ ਲੱਗਦਾ ਟਰੈਕਿੰਗ ਕਰਨਾ ਮੈਂ ਅਕਸਰ ਸਾਲ ਦੇ ਵਿੱਚ ਹਰ ਮਹੀਨੇ ਕਹਿ ਲਓ ਜਾਂ ਫਿਰ ਦੋ ਤਿੰਨ ਮਹੀਨਿਆਂ ਬਾਅਦ ਕਿਤੇ ਨਾ ਕਿਤੇ ਜਿਵੇਂ ਕਸੋਲ ਹੋ ਗਿਆ ਕਸੋਲੀ ਵਾਲੀ ਸਾਈਡ ਹੋ ਗਿਆ ਜਾਂ ਕੋਈ ਪਹਾੜੀ ਏ ਏਰੀਆ ਜਿੱਥੇ ਅੱਛੇ ਤਰੀਕੇ ਨਾਲ ਮੈਂ ਦੋ ਤਿੰਨ ਤਿੰਨ ਚਾਰ ਘੰਟਿਆਂ ਦੀ ਟਰੈਕਿੰਗ ਕਰ ਸਕਾਂ ਮੈਂ ਇੱਥੇ ਜ਼ਰੂਰ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਟਰੈਕਿੰਗ ਕਰਨ ਨਾਲ ਇੱਕ ਤਾਂ ਤੁਹਾਡੀ ਬੋਡੀ ਦੀ ਜਿਹੜੀ ਫਿਟਨੈਸ ਹੈ ਤੁਹਾਡੀ ਬੋਡੀ ਦਾ ਬੈਲਂਸ ਹੈ ਉਹ ਬੜਾ ਹੀ ਵਧੀਆ ਮੈਂਟੇਨ ਹੁੰਦਾ ਤੁਸੀਂ ਕਹਿੰਦੇ ਹੋ ਕਿ ਹਾਂ ਆਪਾਂ ਮੋਸਟਲੀ ਲੋਕ ਕੀ ਕਰਦੇ ਨੇ ਕਿ ਜਿੰਮ ਜਾਂਦੇ ਨੇ ਜਿੰਮ ਜਾ ਕੇ ਇੰਨਾਂ ਆਪਾਂ ਆਪਣੇ ਵੇਟ ਜੋ ਲੋਕ ਆਪਣਾ ਵੇਟ ਨੂੰ ਮੇਨਟੇਨ ਕਰਕੇ ਰੱਖਣਾ ਚਾਹੁੰਦੇ ਨੇ ਨਾ ਮੋਸਟਲੀ ਅਤੇ ਮੈਂ ਉਹਨਾਂ ਪਰਸਨਸ ਦੇ ਵਿੱਚ ਵਿਅਕਤੀਆਂ ਦੇ ਵਿੱਚੋਂ ਹਾਂ ਕਿ ਮੈਂ ਟਰੈਕਿੰਗ ਕਰਕੇ ਆਪਣਾ ਵੇਟ ਨੂੰ ਮੇਨਟੇਨ ਰੱਖਦੀ ਹਾਂ ਇਸ ਕਰਕੇ ਸਭ ਤੋਂ ਜ਼ਿਆਦਾ ਮੈਨੂੰ ਟਰੈਕਿੰਗ ਕਰਨਾ ਪਸੰਦ ਹੈ ਇਸ ਤੋਂ ਇਲਾਵਾ ਮੈਨੂੰ ਸਵੀਮਿੰਗ ਦਾ ਸਵੀਮ ਵਿੰਗ ਦਾ ਵੀ ਬਹੁਤ ਸ਼ੌਂਕ ਹੈ ਕਿਉਂਕਿ ਮੈਂ ਜਿਹੜੀ ਬੋਡੀ ਫਿਟਨੈਸ ਆ ਮੈਂ ਆਪਣੀ ਬੋਡੀ ਨੂੰ ਬਹੁਤ ਅੱਛੇ ਤਰੀਕੇ ਨਾਲ ਮੇਨਟੇਨ ਕਰਕੇ ਰੱਖਣਾ ਚਾਹੁੰਦੀ ਹਾਂ ਅਤੇ ਮੈਨੂੰ ਇੱਕ ਟਰੈਕਿੰਗ ਕਰਨਾ ਬਹੁਤ ਪਸੰਦ ਹੈ ਇੱਕ ਮੈਨੂੰ ਸਵੀਮਿੰਗ ਕਰਨਾ ਬਹੁਤ ਪਸੰਦ ਹੈ ਇਸ ਲਈ ਸਵੀਮਿੰਗ ਕਰਨ ਨਾਲ ਜਿਹੜਾ ਸਰੀਰ ਹੈ ਨਾ ਉਹ ਤੁਹਾਡਾ ਪੂਰਾ ਫਿਟ ਐਂਡ ਫਾਈਨ ਰਹਿੰਦਾ ਅਤੇ ਇਹ ਮੇਰੀਆਂ ਦੋ ਇਹ ਦੋ ਚੀਜ਼ਾਂ ਨੇ ਜੋ ਮੈਨੂੰ ਇੱਕ ਤਾਂ ਮੇਰੇ ਬ ਸਰੀਰ ਨੂੰ ਫਿੱਟ ਰੱਖਦੀਆਂ ਦੂਜਾ ਮੇਰੇ ਐਂਟਰਟੇਨਮੈਂਟ ਦਾ ਵੀ ਇੱਕ ਸੋਰਸ ਹਨ